ਮੇਰੇ ਕੋਲ ਗਾਉਣ ਲਈ ਬਹੁਤ ਸਾਰੇ ਗੀਤ ਹਨ ਪਰ ਉਹਨਾਂ 'ਚੋਂ ਕੀ ਹੈ ਜੋ ਸਤਿੰਦਰ ਸਰਤਾਜ ਜੀ ਦੇ ਸੌਂਗ ਨੇ ਉਹ ਮੈਨੂੰ ਬਹੁਤ ਪਸੰਦ ਹੈ ਮੇਰੇ ਫੈਵਰੇਟ ਸਿੰਗਰ ਵੀ ਨੇ ਉਹ ਠੀਕ ਹੈ ਉਹਨਾਂ ਦੇ ਜਿਹੜੇ ਸੌਂਗ ਹੈਗੇ ਆ ਉਹ ਲਾਈਫ ਨਾਲ ਰਿਲੇਟ ਕਰਦੇ ਹੁੰਦੇ ਆ ਕੋਈ ਵੀ ਸੌਗ ਆ ਉਹਨਾਂ ਦਾ ਉਹ ਹਰ ਇੱਕ ਦੀ ਲਾਈਫ ਨਾਲ ਰਿਲੇਟ ਕਰਦੇ ਆ ਸੌਂਗ ਜਿਹੜੇ ਉਹਨਾਂ ਦੇ ਉਹ ਉਹਨਾਂ ਦੇ ਸੌਂਗ ਜਿਹੜੇ ਹੈਗੇ ਸੂਫੀਆਨਾ ਸੌਂਗਸ ਹੁੰਦੇ ਨੇ ਔਰ ਉਹਨਾਂ ਜੋ ਵਰਡਿੰਗ ਹੁੰਦੀ ਆ ਉਹ ਬਾ ਕਮਾਲ ਹੁੰਦੀ ਆ ਉਹ ਸੁਣ ਕੇ ਮੈਨੂੰ ਕਈ ਵਾਰ ਮੇਰਾ ਮੂਡ ਬਹੁਤ ਖਰਾਬ ਹੁੰਦਾ ਕਈ ਵਾਰੀ ਬਹੁਤ ਅੱਛਾ ਹੁੰਦਾ ਠੀਕ ਹੈ ਕਈ ਵਾਰੀ ਮੈਂ ਡੀਮੋਟੀਵੇਟ ਹੋ ਜਾਂਦੀ ਹਾਂ ਕਈ ਵਾਰੀ ਬਟ ਉਹਨਾਂ ਦੇ ਸੌਂਗਸ ਜਿਹੜੇ ਹੈਗੇ ਸੁਣ ਕੇ ਕਿ ਹੈ ਮੋਟੀਵੇਸ਼ਨ ਮਿਲ ਰਹੀ ਹੈਗੀ ਹੈ ਕੁਝ ਕੁ ਸੋਂਗ ਮੋਟੀਵੇਟ ਕਰਨ ਵਾਲੇ ਹੁੰਦੇ ਆ ਠੀਕ ਹੈ ਕੁਛ ਕੁ ਸੋਂਗ ਜਿਹੜੇ ਹੈਗੇ ਆਪਣੀ ਲਾਈਫ ਨਾਲ ਰਿਲੇਟ ਕਰਦੇ ਹੁੰਦੇ ਆ ਅਤੇ ਉਹਨਾਂ ਦੇ ਮਤਲਬ ਸੌਗਸ ਇੱਦਾਂ ਦੇ ਨੇਗੇ ਅਗਰ ਬ ਬੰਦੇ ਦਾ ਮੂਡ ਖਰਾਬ ਹੋਏਗਾ ਅਤੇ ਉਹ ਸੌਂਗ ਸੁਣ ਕੇ ਸਹੀ ਹੋ ਜਾਏਗਾ ਹੁਣ ਉਹਨਾਂ ਸੌਂਗਸ ਵਿੱਚੋਂ ਇੱਕ ਮੇਰਾ ਬਹੁਤ ਜ਼ਿਆਦਾ ਫੇਵਰਿਟ ਸੌਂਗ ਆ ਕਿ ਬੰਦੇ ਦੇ ਹੱਥਾਂ ਨਾਲੋਂ ਕੋਈ ਔਜ਼ਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਕਿੰਨਾ ਕੁਝ ਬਣ ਗਿਆ ਲੇਕਿਨ ਕੁਦਰਤ ਤੋਂ ਪਾਰ ਨਹੀਂ ਬਣਿਆ ਇਹ ਬਹੁਤ ਜ਼ਿਆਦਾ ਪਸੰਦ ਆ ਮੈਨੂੰ ਸੌਂਗ ਇਹਦੇ ਵਿੱਚ ਇਹ ਕਿਹਾ ਗਿਆ ਕਿ ਜੋ ਮਤਲਬ ਇਨਸਾਨ ਦੇ ਹੱਥ ਨੇ ਉਹਨਾਂ ਤੋਂ ਬਹੁ ਵੱਡਾ ਕੋਈ ਵੀ ਮਤਲਬ ਕੁਛ ਵੀ ਨਹੀਂ ਇਸ ਦੁਨੀਆਂ 'ਤੇ ਬੰਦਾ ਜੋ ਚਾਹੇ ਉਹ ਕਰ ਸਕਦਾ ਆਪਣੇ ਇਹਨਾਂ ਹੱਥਾਂ ਨਾਲ ਬਸ ਉਹਨੂੰ ਕਰਨ ਦੀ ਹਿੰਮਤ ਹੋਣੀ ਚਾਹੀਦੀ ਹੈ ਇਸ ਲਈ ਜੋ ਸੂਫੀਆਂਨਾ ਸੌਂਗ ਨੇ ਸਤਿੰਦਰ ਸਰਤਾਜ ਜੀ ਦੇ ਉਹ ਮੇਰੇ ਫੇਵਰਟ ਫੇਵਰਟ ਟੂ ਫੇਵਰੇਟ ਸੌਂਗ ਬਹੁਤ ਜ਼ਿਆਦਾ ਮਨ ਪਸੰਦ ਨੇ ਮਤਲਬ